ਹੈਲੋ ਬਸ ਵਧੀਆ ਤੂੰ ਦੱਸ ਮੈਂ ਫਾਈਲ ਦੇ ਵਿੱਚ ਲੱਗਿਆ ਹੋਇਆਂ ਯਾਰ ਆਪਣੀ ਜੇਈ ਵਾਸਤੇ

ਨਹੀਂ ਹਾਂ ਹਾਂ ਵਿਕਾਸ ਵਿਕਾਸ ਵਿਕਾਸ ਤਾਂ ਕੋਚਿੰਗ ਇੰਸਟੀਚਿਊਟ ਲੱਗਿਆ ਹੋਇਆ ਇਹ ਹਰ ਸਾਲ ਦੀ ਇਕੱਠੀ ਦੇਣੀ ਪੈਂਦੀ ਹੈ ਤੀਹ ਹਜ਼ਾਰ ਰੁਪਈਆ ਲੈਂਦੇ ਹੈ ਹਰ ਸਬਜੈਕਟ ਦਾ ਦਸ ਲੈਂਦੇ ਨਹੀਂ ਮਹੀਨੇ ਦਾ ਨਹੀਂ ਮਹੀਨੇ ਦਾ ਨਹੀਂ ਗਾ ਤੈਨੂੰ ਸਰ ਜਿਹੜਾ ਜਿਹੜਾ ਤੂੰ ਸਬਜੈਕਟ ਕਰਨਾ ਉਹਦਾ ਦਸ ਹਜ਼ਾਰ ਰੁਪਈਆ ਹੈ ਹਾਂ ਜਿੰਨੇ ਕਰਨੇ ਹੈ ਹਾਂ ਹਰ ਸਬਜੈਕਟ ਦਾ ਦਸ ਹਜ਼ਾਰ ਹੈ ਤਾਂ ਫਿਜ਼ਿਕਸ ਕਮੀਸਟ੍ਰੀ ਮੈਥ ਜਿਹੜਾ ਜਿਹੜਾ ਕਰਨਾ ਜਿਹੜਾ ਜਿਹੜਾ ਲੈਣਾ ਉਹਦਾ ਦਸ ਦਸ ਹਜ਼ਾਰ ਰੁਪਈਆ ਹਾਂ ਹਾਂ ਇੱਕ ਸਿੱਖ ਇੰਸਟੀਟਿਊਟ ਹੈਗਾ ਉਹ ਮਲਕਾਨੇ ਮੁਹੱਲੇ ਹੀ ਹੈ ਹਾਂ ਫੀਸ ਉੱਧਰ ਵੀ ਸੇਮ ਹੈ ਹਾਂ ਸੇਮ ਹੀ ਹੈ ਫੀਸ ਪਰ ਬੱਚੇ ਘੱਟ ਨੇ ਉੱਥੇ ਹਾਂ ਉਹ ਮਲਕਾਨੇ ਮੁਹੱਲੇ ਵਾਲੇ ਪਾਸੇ ਹੈ ਕਿੱਥੇ ਮੈਨੂੰ ਪੱਕਾ ਨਹੀਂ ਪਤਾ ਕਿੱਥੇ ਆ ਉਹ ਪਰ ਹਾਂ ਉਹ ਵੇਖਣਾ ਪਏਗਾ ਅੱਛਾ ਹਾਂ ਹਾਂ ਇੰਸਟੀਚਿਊਟ ਤਾਂ ਸਾਰੇ ਇੱਕੋ ਵਰਗੇ ਨੇ ਮਤਲਬ ਟੀਚਰਾਂ ਨੇ ਹੀ ਪੜ੍ਹਾਉਣਾ ਹੈ ਉਸ ਤੋਂ ਬਾਅਦ ਤਾਂ ਕੰਮ ਹੀ ਕਰਨਾ ਹੈ ਹਾਂ ਮੈਨੂੰ ਹੋ ਗਏ ਦੋ ਮਹੀਨੇ ਹੋ ਗਏ ਜਾਂਦੇ ਹੋਏ ਅਤੇ ਹੱਲੇ ਜ਼ਿਆਦਾ ਤੇਜ਼ ਨਹੀਂ ਕੰਮ ਕਰਵਾਈ ਜਾਂਦੇ ਹਮ ਨਹੀਂ ਮੈਂ ਤੇਰੇ ਨਾਲ ਹਾਂ ਤੇਰੇ ਨਾਲ ਚੱਲ ਪਵਾਂਗੇ ਕੋਈ ਗੱਲ ਨਹੀਂ ਐਵੇਂ ਰੋਕਦੇ ਥੋੜ੍ਹੀ ਹੈ ਦੂਜੇ ਇੰਸਟੀਚਿਊਟ ਵਾਲਿਆਂ ਨੂੰ ਵੜਨ ਵਾਸਤੇ ਕੋਈ ਨਹੀਂ ਜੀ ਮੈਂ ਦੂਜੇ ਵੇਖ ਲਵਾਂਗਾ ਨਹੀਂ ਤਾਂ ਹਾਂ ਚੱਲ ਮੈਨੂੰ ਦੱਸ ਦਈਂ ਇੱਕ ਵਾਰੀ ਅਗਰ ਮੈਂ ਟ੍ਰੈਲ ਵਾਸਤੇ ਵੇਖਣਾ ਆ ਤੈਨੂੰ ਉਸੇ ਹਿਸਾਬ 'ਤੇ ਟ੍ਰੈਲ ਇਕੱਠੇ ਕਰਲਾਂਗੇ ਓਕੇ